ਮੈਨੂੰ ਮੇਰੇ ਪ੍ਰੋਡਕਟ ਦੀ ਦੋ ਗੱਲਾਂ ਕਾਫ਼ੀ ਪਰੇਸ਼ਾਨ ਕਰਦੀਆਂ ਹਨ ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਹੈ ਮੈਨੂੰ ਕਦੇ ਕਦੇ ਲੱਗਦਾ ਹੈ ਕਿ ਇਹ ਟੀ ਵੀ ਜਦ ਮੈਂ ਖਰੀਦਿਆ ਸੀ ਤਦ ਕੁਛ ਹੋਰ ਸੀ ਅਤੇ ਹਲੇ ਜਦ ਚੱਲਦਾ ਹੈ ਉਹ ਤਦ ਕੁਛ ਹੋਰ ਹੈਗਾ ਜਿਵੇਂ ਕਿ ਮੈਂ ਜਦ ਟੀ ਵੀ ਦੇਖ ਰਿਹਾ ਸੀ ਤਦ ਮੈਂ ਦੇਖਿਆ ਕਿ ਵਿੱਚ ਵਿਚ ਵਿੱਚ ਉਸਦੀ ਪਿਕਚਰ ਟਿਊਬ ਖ਼ਰਾਬ ਹੋ ਜਾਂਦੀ ਹੈ ਮਤਲਬ ਕਿ ਉਹਦੀ ਪਿਕਚਰ ਗਾਇਬ ਹੋ ਜਾਂਦੀ ਹੈ ਜਿਸ ਕਰਕੇ ਮੈਨੂੰ ਬਹੁਤ ਖ਼ਰਾਬ ਲੱਗਦਾ ਹੈ ਮੇਰੇ ਦੋਸਤ ਵੀ ਕਹਿੰਦੇ ਆ ਕਿ ਕਿੱਥੋਂ ਇਹ ਕਿਹੜਾ ਟੀ ਵੀ ਤੂੰ ਖਰੀਦ ਲਿਆ ਜਿਸ 'ਚ ਕਾਫ਼ੀ ਵਾਰ ਪਿਕਚਰ ਟਿਊਬ ਉੜ ਜਾਂਦੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਟੀ ਵੀ ਵਧੀਆ ਤਾਂ ਹੈਗਾ ਕਹਿੰਦੇ ਲੋਕ ਲੇਕਿਨ ਮੈਨੂੰ ਲੱਗਦਾ ਕਿਸੇ ਨੇ ਗਲਤ ਮਾਲ ਫੜਾ ਦਿੱਤਾ ਹੈ ਇਸ 'ਚ ਕਾਫ਼ੀ ਵਾਰ ਮੈਨੂੰ ਓਹ ਪਸੰਦ ਨਹੀਂ ਆਇਆ ਇਹ ਟੀ ਵੀ ਮੈਨੂੰ ਇਹ ਪਸੰ ਟੀ ਵੀ ਚੇਂਜ ਕਰਵਾਉਣਾ ਹੈ ਮੈਨੂੰ ਇਹ ਟੀ ਵੀ ਦੀ ਲੋੜ ਨਹੀਂ ਮੈਨੂੰ ਦੂਜਾ ਟੀ ਵੀ ਚਾਹੀਦਾ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰਾ ਟੀ ਵੀ ਛੇਤੀ ਚੇਂਜ ਕਰਾ ਦਿੱਤਾ ਜਾਵੇ ਜੋ ਕਿ ਮੈਂ ਆਪਣੀ ਨਏ ਨਈਂ ਟੀ ਵੀ ਜਾਂ ਨੇਆਂ ਪ੍ਰੋਡਕਟ ਲੈ ਸਕਾਂ ਧੰਨਵਾਦ